ਸਤਿ ਸ਼੍ਰੀ ਅਕਾਲ ਜੀ ਉਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਤੋਂ ਬੜੇ ਹੀ ਸਬਕ ਸਿੱਖੇ ਹਨ ਜੇਕਰ ਕੁਝ ਮਹੱਤਵਪੂਰਨ ਸਬਕ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਸਭ ਤੋਂ ਜ਼ਿੰਦਗੀ ਦਾ ਸਬਕ ਇਹ ਮਿਲਿਆ ਕਿ ਸਾਨੂੰ ਆਪਣੇ ਪੈਰਾਂ ਤੋਂ ਚੰਗੀ ਤਰ੍ਹਾਂ ਨਾਲ਼ ਸਟੈਂਡ ਹੋਣਾ ਚਾਹੀਦਾ ਜਿੱਦਾਂ ਕਿ ਸਾਨੂੰ ਆਪਣਾ ਕਾਰੋਬਾਰ ਕਰਨਾ ਚਾਹੀਦਾ ਜਿਸ ਤਰ੍ਹਾਂ ਮੈਂ ਪਹਿਲੇ ਨੌਕਰੀ ਕਰਦਾ ਸੀ ਅਤੇ ਮੈਨੂੰ ਲੱਗਦਾ ਸੀ ਕਿ ਕਿਸੇ ਦੇ ਥੱਲੇ ਨੌਕਰੀ ਕਰਕੇ ਅਸੀਂ ਕਿਸੇ ਦਾ ਰੋਹਬ ਸਹਿੰਦੇ ਹਾਂ ਤਾਂ ਫਿਰ ਉਸ ਥਾਂ ਉਸ ਦੀ ਥਾਂ ਤੋਂ ਮੈਂ ਕਈ ਤਰੀਕੇ ਦੇ ਸਬਕ ਲੈ ਕੇ ਕਈ ਚੀਜ਼ਾਂ ਸਿੱਖ ਕੇ ਅਤੇ ਮੈਂ ਹੁਣ ਆਪਣਾ ਕੰਮ ਪਾਇਆ ਹੈ ਇਸ ਤੋਂ ਮੈਂ ਇਹ ਸਬਕ ਲਿਆ ਕਿ ਹੁ ਹੁਣ ਸਾਨੂੰ ਆਪਣਾ ਕੰਮ ਕਰਨਾ ਆਉਣਾ ਚਾਹੀਦਾ ਹੈ ਅਤੇ ਕਿਸੇ ਅਤੇ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ ਹੁਣ ਕਿਸ ਜੀ ਹੁਣ ਜਿਸ ਤਰ੍ਹਾਂ ਮੇਰੇ ਗੁਆਂਢ ਦੇ ਕਿ ਵਿੱਚ ਇੱਕ ਬੰਦਾ ਰਹਿੰਦਾ ਸੀ ਉਸ ਤੋਂ ਇਹ ਸਬਕ ਸਿੱਖਿਆ ਕਿ ਜਿਸ ਤਰ੍ਹਾਂ ਜਦੋਂ ਉਹਨੂੰ ਲੋੜ ਸੀ ਤਾਂ ਮੈਂ ਉਸਨੂੰ ਪੈਸੇ ਦਿੱਤੇ ਸਨ ਅਤੇ ਜਦੋਂ ਮੈਨੂੰ ਉਸਦੀ ਲੋੜ ਪਈ ਤਾਂ ਉਸਨੇ ਮੈਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਮੈਨੂੰ ਮੈਨੂੰ ਇਹ ਸਬਕ ਮਿਲਿਆ ਕਿ ਇੱਥੇ ਕੋਈ ਵੀ ਆਪਣਾ ਨਹੀਂ ਹੁੰਦਾ ਸਾਨੂੰ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਸਾਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਸ ਨੇ ਮੈਨੂੰ ਪੈਸੇ ਨਹੀਂ ਦਿੱਤੇ ਅਤੇ ਉਹ ਮੇਰਾ ਉਸ ਵੇਲੇ ਬੜਾ ਹੀ ਮਨ ਦੁਖਿਆ ਕਿ ਲੋੜ ਪੈਣ 'ਤੇ ਮੇਰਾ ਆਪਣਾ ਹੀ ਕੰਮ ਨਹੀਂ ਆਇਆ ਇਹ ਤੋਂ ਮੈਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਆਪਣਾ ਨਹੀਂ ਹੁੰਦਾ ਸਾਨੂੰ ਆਪਣੇ ਪੈਰਾਂ 'ਤੇ ਖੁਦ ਆਪਣਾ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਜੀ